ਜੇ ਆਪਾਂ ਚਿੱਤਰਕਾਰੀ ਦੀ ਗੱਲ ਕਰੀਏ ਚਿੱਤਰਕਾਰੀ ਇਹ ਇੱਕ ਬਹੁਤ ਹੀ ਰੁਚੀ ਵਾਲੀ ਇੱਕ ਕਲਾਸ ਹੁੰਦੀ ਹੈ ਜਿਹਦੇ ਵਿੱਚ ਇੱਕ ਚਿੱਤਰਕਾਰ ਆਪਣੀ ਚਿੱਤਰਕਾਰੀ ਪੇਸ਼ ਕਰਦਾ ਹੈ ਵੱਖ ਵੱਖ ਉਹਦੇ ਵਿੱਚ ਦਿਮਾਗ ਦੇ ਵਿੱਚ ਜਦੋਂ ਚਿੱਤਰਕਾਰੀ ਚੱਲਦੀ ਹੈ ਅਤੇ ਕਈ ਤਰ੍ਹਾਂ ਦੀਆਂ ਅਸੀਂ ਉਹਦੇ ਵਿੱਚ ਕਈ ਕਈ ਤਰ੍ਹਾਂ ਦੀਆਂ ਪੈਨਸਲਾਂ ਯੂਜ਼ ਕਰਕੇ ਅਸੀਂ ਚਿੱਤਰਕਾਰੀ ਕਰ ਸਕਦੇ ਹਾਂ ਚਿੱਤਰਕਾਰੀ ਦੇ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਪੈਨਸਲਾਂ ਜਿਵੇਂ ਕਿ ਨੌ ਐਚ ਤੋਂ ਲੈ ਕੇ ਨੌ ਬੀ ਇੱਕ ਤਰ੍ਹਾਂ ਦੀ ਇੱਕ ਰੇਂਜ ਹੁੰਦੀ ਹੈ ਸਤਾਰ੍ਹਾਂ ਅਠਾਰ੍ਹਾਂ ਪੈਨਸਲਾਂ ਹੁੰਦੀਆਂ ਹਨ ਉਹਦੇ ਵਿੱਚ ਅਸੀਂ ਚਿੱਤਰਕਾਰੀ ਕੋਈ ਫਿੱਕੀ ਲਾਉਣੀ ਹੈ ਅਤੇ ਕੋਈ ਲਾਈਨ ਅਸੀਂ ਕੋਈ ਡਾਰਕ ਲਾਉਣੀ ਹੈ ਅਤੇ ਇਸ ਲਈ ਚਿੱਤਰਕਾਰੀ ਸਾਨੂੰ ਬਹੁਤ ਹੀ ਅੱਛੀ ਲੱਗਦੀ ਹੈ ਅਤੇ ਇਹ ਵਰਕਸ਼ੋਪ ਵੀ ਅਸੀਂ ਕਰਵਾ ਸਕਦੇ ਹਾਂ ਅਤੇ ਅਸੀਂ ਕਲਾਸਾਂ ਵੀ ਇਹਦੇ ਵਿੱਚ ਲਾਈਆਂ ਹੋਈਆਂ ਨੇ ਅਤੇ ਇਹ 'ਚ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ ਚਿੱਤਰਕਾਰੀ ਦਾ ਅਨੁਭਵ ਸਾਡੇ ਲਈ ਬਹੁਤ ਹੀ ਚੰਗਾ ਹੈ ਅਤੇ ਅਸੀਂ ਅੱਗੇ ਬੱਚਿਆਂ ਨੂੰ ਵੀ ਚਿੱਤਰਕਾਰੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾ ਸਕਦੇ ਹਾਂ ਅਤੇ ਦੂਜੀ ਗੱਲ ਇਹਦੇ ਵਿੱਚ ਚਿੱਤਰਕਾਰ ਬਣਨ ਤੋਂ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਕਈ ਤਰ੍ਹਾਂ ਦੇ ਰੰਗ ਜੋ ਕਿ ਅਸੀਂ ਭਰ ਸਕਦੇ ਹਾਂ ਜਿਹਦੇ ਵਿੱਚ ਕ੍ਰੇਅਨ ਕਲਰ ਅੱਜ ਕੱਲ੍ਹ ਬੱਚੇ ਯੂਜ ਕਰਦੇ ਹਨ ਉਹ ਵੀ ਅਸੀਂ ਇਹਦੇ 'ਚ ਭਰ ਸਕਦੇ ਹਾਂ ਸਕੈਚ ਪੈਨ ਅਸੀਂ ਯੂਜ ਕਰ ਸਕਦੇ ਹਾਂ ਅਸੀਂ ਇਹਦੇ ਵਿੱਚ ਪੈਨਸਲ ਕਲਰਸ ਯੂਜ ਕਰ ਸਕਦੇ ਹਾਂ ਵਾਟਰ ਕਲਰ ਅਸੀਂ ਯੂਜ ਕਰ ਸਕਦੇ ਹਾਂ ਯਾਨੀ ਕਿ ਚਿੱਤਰਕਾਰ ਵਿੱਚ ਰੰਗ ਚਿੱਤਰਕਾਰੀ ਵਿੱਚ ਰੰਗ ਭਰਨ ਤੋਂ ਬਾਅਦ ਇਹ ਬਹੁਤ ਹੀ ਮਨਮੋਹਕ ਇੱਕ ਚਿੱਤਰਕਾਰੀ ਨਿਕਲ ਕੇ ਆਉਂਦੀ ਹੈ ਜੋ ਕਿ ਸਾਡੇ ਦਿਲ ਨੂੰ ਇੱਕ ਸਕੂਨ ਦਿੰਦੀ ਹੈ ਅਤੇ ਇਹ ਚਿੱਤਰਕਾਰੀ ਅੱਗੇ ਵੀ ਵੱਧ ਤੋਂ ਵੱਧ ਅਸੀਂ ਕਲਾਸਾਂ ਵਿੱਚ ਅਸੀਂ ਬੱਚਿਆਂ ਨੂੰ ਵੀ ਦੱਸਦੇ ਹਾਂ ਕਰਨ ਲਈ ਅਤੇ ਜੇ ਕੰਪਟੀਸ਼ਨ ਦੀ ਕਰਦੇ ਹਾਂ ਵਰਕਸ਼ਾਪਾਂ ਵੀ ਲਾਉਂਦੇ ਹਾਂ ਅਤੇ ਇਸ ਲਈ ਇਹ ਸਾਨੂੰ ਬਹੁਤ ਵਧੀਆ ਲੱਗਦੀ ਹੈ